ਪੰਜਾਬ ਦੇ ਇਤਿਹਾਸ ਨੂੰ ਬਹੁਤ ਸਾਰੇ ਪ੍ਰਮੁੱਖ ਸੱਭਿਆਚਾਰਕ ਪ੍ਰਭਾਵਾਂ ਦੇ ਆਕਾਰ ਦਿੱਤਾ ਹੈ ਇਨ੍ਹਾਂ ਵਿੱਚ ਧਰਮ ਭਾਸ਼ਾ ਕਲਾ ਆਰਕੀਟੈਕਚਰ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਆਓ ਹਰ ਇੱਕ ਦੇ ਕੁਝ ਮੁੱਖ ਅੰਗ 'ਤੇ ਨਜ਼ਰ ਮਾਰੀਏ ਧਰਮ ਧਰਮ ਸਿੱਖ ਧਰਮ ਦਾ ਜਨਮ ਪੰਦਰ੍ਹਵੀਂ ਸਦੀ ਵਿੱਚ ਪੰਜਾਬ ਵਿੱਚ ਹੋਇਆ ਗੁਰੂ ਨਾਨਕ ਦੇਵ ਜੀ ਇਸ ਧਰਮ ਦੇ ਸੰਪਾਦਕ ਸਨ ਸਿੱਖਾਂ ਧਰਮ ਦੀਆਂ ਸਿੱਖਾਂ ਅਤੇ ਗੁਰਬਾਣੀ ਨੇ ਪੰਜਾਬੀ ਲੋਕਾਂ ਦੇ ਜੀਵਨ ਸੱਭਿਆਚਾਰ ਅਤੇ ਰੀਤੀ ਰਿਵਾਜ਼ 'ਤੇ ਗਹਿਰਾ ਪ੍ਰਭਾਵ ਪਾਇਆ ਸੰਯੁਕਤ ਧਰਮ ਇਸ ਖੇਤਰ ਨੇ ਬੁੱਧ ਧਰਮ ਜੈਨ ਧਰਮ ਹਿੰਦੂ ਧਰਮ ਅਤੇ ਇਸਲਾਮ ਜਿਹੇ ਧਰਮਾਂ ਨੂੰ ਵੀ ਗ੍ਰਹਿਣ ਕੀਤਾ ਹੈ ਇਨ੍ਹਾਂ ਧਰਮਾਂ ਦੇ ਰਵਾਇਤੀ ਤਿਉਹਾਰ ਅਤੇ ਰੀਤ ਰਿਵਾਜ਼ਾਂ ਨੂੰ ਪੰਜਾਬੀ ਲੋਕ ਆਦਰ ਅਤੇ ਮਾਣ ਦਿੰਦੇ ਹਨ ਭਾਸ਼ਾ ਭਾਸ਼ਾ ਪੰਜਾਬੀ ਭਾਸ਼ਾ ਪੰਜਾਬ ਦੀ ਮੁੱਖ ਭਾਸ਼ਾ ਹੈ ਅਤੇ ਇਸਦਾ ਵਿਕਾਸ ਸਦੀਆਂ ਤੋਂ ਹੁੰਦਾ ਆ ਰਿਹਾ ਹੈ ਪੰਜਾਬੀ ਸਾਹਿਤ ਸ਼ਾਇਰੀ ਅਤੇ ਗੀਤਾਂ ਨੇ ਲੋਕਾਂ ਦੇ ਜੀਵਨ ਅਤੇ ਸੱਭਿਆਚਾਰਕ ਵਿਰਾਸਤ 'ਤੇ ਗਹਿਰਾ ਪ੍ਰਭਾਵ ਪਾਇਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਪਵਿੱਤਰ ਗ੍ਰੰਥ ਹਨ ਇਹ ਵੀ ਪੰਜਾਬੀ ਭਾਸ਼ਾ ਵਿੱਚ ਲਿਖਿਆ ਗਿਆ ਹੈ ਉਰਦੂ ਅਤੇ ਫ਼ਾਰਸੀ ਇਸਲਾਮ ਦੇ ਅਰਬੀ ਅਤੇ ਫ਼ਾਰਸੀ ਪ੍ਰਭਾਵਾਂ ਦੇ ਕਾਰਨ ਉਰਦੂ ਭਾਸ਼ਾ ਦਾ ਵੀ ਪੰਜਾਬ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਹੈ ਖਾਸ ਕਰਕੇ ਮੱਧਕਾਲੀ ਕਵਿਤਾ ਅਤੇ ਸਿਹਤ ਵਿੱਚ ਸੱਭਿਆਚਾਰਕ ਪਰੰਪਰਾਵਾਂ ਜਿਵੇਂ ਕਿ ਭੰਗੜਾ ਅਤੇ ਗਿੱਧਾ ਪੰਜਾਬ ਦੇ ਲੋਕ ਨ੍ਰਿੱਤ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹਨ ਇਹ ਨ੍ਰਿੱਤ ਰੂਪੀ ਖੁਸ਼ੀ ਅਤੇ ਜੋਸ਼ ਦਾ ਪ੍ਰਤੀਕ ਹਨ ਅਤੇ ਵੱਖ ਵੱ ਅਕਸਰ ਵੱਖ ਵੱਖ ਮੌਕਿਆਂ 'ਤੇ ਕੀਤੇ ਜਾਂਦੇ ਹਨ ਧੰਨਵਾਦ